ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰ ਦੇ ਆਲਾ ਦੁਆਲਾ ਹਮੇਸ਼ਾ ਸਾਫ ਰੱਖੇ ਉਥੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੂੜਾ ਕਰਕਟ ਜਮਾ ਨਹੀਂ ਹੋਣਾ ਘਰ ਦੇ ਆਲੇ ਦੁਆਲੇ ਜਮਾ ਹੋਇਆ ਕੂੜਾ ਕਰਕਟ ਬਿਮਾਰੀਆਂ ਨੂੰ ਭੈੜੀਆਂ ਬਿਮਾਰੀਆਂ ਨੂੰ ਨਿਮੰਤਰਨ ਕਰਦਾ ਹੈ ਇਹ ਬਿਮਾਰੀਆਂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਗ ਕੇ ਬਹੁਤ ਨੁਕਸਾਨ ਕਰਦੀਆਂ ਹਨ ਇਹਨਾਂ ਬਿਮਾਰੀਆਂ ਤੋਂ ਨਿਪਟਾਰੇ ਲਈ ਬਾਅਦ ਚ ਦਵਾਈਆਂ ਖਾਣ ਲਈ ਜਾਂ ਵੱਖ ਵੱਖ ਤਰ੍ਹਾਂ ਦੇ ਉਪਾ ਕਰਨ ਲਈ ਇਸ ਤੋਂ ਚੰਗਾ ਹੈ ਕਿ ਪਹਿਲਾਂ ਹੀ ਘਰ ਦੇ ਆਲਾ ਦੁਆਲਾ ਸਾਫ ਰੱਖਿਆ ਜਾ ਸਕੇ ਤੁਹਾਡੇ ਘਰ ਦੇ ਆਲੇ ਦੁਆਲਿਆਂ ਨੂੰ ਸਾਫ ਰੱਖਣ ਲਈ ਤੁਸੀਂ ਕਈ ਪ੍ਰਕਾਰ ਦੇ ਯਤਨ ਕਰ ਸਕਦੇ ਹੋ ਗਹਿਰੀ ਇਲਾਕੇ ਨੂੰ ਸਾਫ ਰੱਖਣ ਲਈ ਕਈ ਅਹਿਮ ਉਪਾਏ ਕੀਤੇ ਜਾ ਸਕਦੇ ਆ ਜਿਵੇਂ ਕੂੜਾ ਕੱਟ ਕੱਟਦਾ ਸਹੀ ਨਿਪਟਾਰਾ ਕਰੋ ਫੋਕਰ ਨੂੰ ਇੱਕ ਸਥਾਨ ਤੇ ਇਕੱਠਾ ਕਰੋ ਅਤੇ ਹਰ ਰੋਜ਼ ਜਾਂ ਹਫਤੇ ਵਿੱਚ ਇਸ ਨੂੰ ਵੇਖੋ ਅਤੇ ਸਹੀ ਤਰੀਕੇ ਨਾਲ ਮੁਲਾਂਕਣ ਕਰੋ ਰੀਸਾਈਕਲਿੰਗ ਕੂੜੇ ਦੇ ਵੱਖ ਵੱਖ ਕੈਟਾਗਰੀਆਂ ਵਿੱਚ ਵੰਡਣ ਨਾਲ ਕਈ ਚੀਜ਼ਾਂ ਨੂੰ ਮੁੜ ਉਪਯੋਗ ਵਿੱਚ ਲਿਆਉਂਦਾ ਹਾਂ ਮੈਂ ਕਈ ਤਰ੍ਹਾਂ ਦੀ ਰਿਸਾਈਕਲਿੰਗ ਕਰਦਾ ਹਾਂ ਗਰਦਨ ਗੱਦੀਆਂ ਦੀ ਸਫਾਈ ਮੈਂ ਕਰਦਾ ਰਹਿੰਦਾ ਹਾਂ ਆਪਣੇ ਬਾਹਰ ਦੇ ਖੇਤਰਾਂ ਨੂੰ ਪਿੰਜਰਾ ਕੀੜਿਆਂ ਅਤੇ ਪੌਦਿਆਂ ਤੋਂ ਸਾਫ ਰੱਖਦਾ ਹਾਂ ਪੌਦਿਆ ਨੂੰ ਸਮੇਂ ਦੇ ਨਾਲ ਪਾਣੀ ਦਿੰਦਾ ਹਾਂ ਕੂਲਰਾਂ ਦੀ ਸਫਾਈ ਟਾਈਮ ਨਾਲ ਕਰਦਾ ਹਾਂ ਗਲੀਆਂ ਨਾਲੀਆਂ ਜੋ ਕਿ ਸ਼ਹਿਰਾਂ ਦੀ ਫਾਲਤੂ ਗੰਦਾ ਪਾਣੀ ਜਿਹਨਾਂ ਵਿੱਚੋਂ ਲੰਘਦਾ ਹੈ ਉੱਥੇ ਜਮਾ ਮੱਛਰ ਜਮਾ ਨਾ ਹੋ ਸਕਣ ਇਸ ਕਰਕੇ ਮੈਂ ਉਹਨਾਂ ਨੂੰ ਵੀ ਹਫਤਾ ਵਾਰ ਸਾਫ ਕਰਦਾ ਹਾਂ ਗਲੀਆਂ ਵਿੱਚ ਵੀ ਝਾੜੂ ਸਵੇਰੇ ਮੈਂ ਹੀ ਲਾਉਂਦਾ ਹਾਂ ਤੇ ਆਪਣਾ ਆਲਾ ਦੁਆਲਾ ਸਾਰਾ ਸਾਫ ਰੱਖਦਾ ਹਾਂ ਪੇੜ ਪੌਦੇ ਲਾਉਂਦਾ ਹਾਂ ਮੈਂ ਆਪਣੇ ਆਲੇ ਦੁਆਲੇ ਦੇ ਹਰ ਪੇੜ ਪੌਦੇ ਅਤੇ ਫਲਾਵਰ ਲਾਉਣ ਦਾ ਸਿਰਫ ਤੰਦਰੁਸਤੀ ਵਧਾਉਂਦਾ ਹਾਂ ਮੈਂ ਸਗੋਂ ਵਾਤਾਵਰਨ ਨੂੰ ਵੀ ਸੁਧਾਰਦਾ ਹਾਂ ਆਪਣੇ ਘਰ ਦੇ ਆਲੇ ਦੁਆਲੇ ਮੇਰੇ ਵਾਂਗੂ ਸਾਰੇ ਬੱਚਿਆਂ ਨੂੰ ਪੇੜ ਪੌਦੇ ਆ ਤੇ ਫੁੱਲ ਫਲ ਲਾਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਵੀ ਸਾਫ ਰਹਿ ਸਕੇ ਅਤੇ ਸਾਡਾ ਘਰ ਵੀ ਸੁੰਦਰ ਦਿਸੇ ਨਿਯਮਿਤ ਸਫਾਈ ਤਾਂ ਤਕਰੀਬਨ ਰੱਖਣੀ ਉਹ ਪੈਂਦੀ ਆ ਹਫਤੇ ਵਿੱਚ ਕੁਝ ਸਮਾਂ ਬਾਹਰ ਕੱਢ ਕੇ ਮੈਂ ਧੂੜ ਅਤੇ ਜੰਗਲਾਂ ਨੂੰ ਸਾਫ ਕਰਨ ਦੇ ਲਈ ਸਮਾਂ ਨਿਕਾਲਦਾ ਹਾਂ ਸਮੂਦਾਇਕ ਬਾਗਬਾਨੀ ਆਪਣੇ ਨੇਬਰਹੁੱਡ ਵਿੱਚ ਲੋਕਾਂ ਨੂੰ ਮਿਲ ਕੇ ਸਾਫ ਸਫਾਈ ਅਤੇ ਵਿਗਿਆਨੀ ਬਾਗਵਾਨੀ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਦਾ ਹਾਂ ਇਹਨਾਂ ਉਪਾਵਾਂ ਨਾਲ ਮੈਂ ਆਪਣਾ ਘਰ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਦਾ ਹੋਰ ਵੀ ਕਈ ਪ੍ਰਕਾਰ ਦੇ ਯਤਨ ਮੇਰੇ ਵੱਲੋਂ ਕੀਤੇ ਜਾਂਦੇ ਹਨ ਜਿਵੇਂ ਮੈਂ ਸੜਕ ਤੇ ਸਵੇਰੇ ਪਾਣੀ ਛਿੜਕਦਾ ਹਾਂ ਤਾਂ ਜੋ ਗੱਡੀਆਂ ਮੋਟਰਾਂ ਕਾਰਾਂ ਨਾਲ ਲੜਕ ਤੇ ਪਈ ਧੂੜ ਉੱਡ ਕੇ ਮੇਰੇ ਘਰ ਵਿੱਚ ਨਾ ਆ ਸਕੇ ਸਾਡੇ ਘਰ ਦੇ ਬਾਹਰ ਦੀ ਜਿਹੜੇ ਵੀ ਗੰਦੇ ਨਾਲੇ ਅਤੇ ਨਾਲੀਆਂ ਨਿਕਲਦੇ ਹਨ ਮੈਂ ਉਹਨਾਂ ਨੂੰ ਵੀ ਤਰਤੀਬ ਨਾਲ ਹਰ ਐਤਵਾਰ ਨੂੰ ਸਾਫ ਰੱਖਦਾ ਹਾਂ ਸਾਫ ਕਰਦਾ ਹਾਂ ਤਾਂ ਜੋ ਉਹਨਾਂ ਵਿੱਚ ਮੱਛਰ ਮੱਖੀਆਂ ਜਮਾ ਨਾ ਹੋ ਸਕੇ ਤੁਹਾਨੂੰ ਪਤਾ ਹੀ ਹੈ ਅੱਜਕੱਲ ਦੇ ਗੰਦੇ ਮੱਛਰ ਕਿਵੇਂ ਡੈਗੂ ਵਰਗੀਆਂ ਭਿਆਨਕ ਬਿਮਾਰੀਆਂ ਲੈ ਕੇ ਆਉਂਦੇ ਹਨ ਇਹਨਾਂ ਤੋਂ ਸੁਰੱਖਿਆ ਲਈ ਮੈਂ ਆਪਣੇ ਘਰ ਦੀਆਂ ਨਾਲੀਆਂ ਧਾੜੀਆਂ ਨੂੰ ਟਾਈਮ ਦੇ ਨਾਲ ਨਾਲ ਸਾਫ ਕਰਦਾ ਰਹਿੰਦਾ ਹਾਂ